ਪੰਜਾਬੀ ਭਾਸ਼ਾ ਜਿਹੜੀ ਹੈ ਸੱਭਿਆਚਾਰਕ ਭਾਸ਼ਾ ਹੈ ਇਹਦਾ ਵਟਾਂਦਰਾ ਸੰਚਾਰ ਵਿੱਚ ਬਹੁਤ ਵਿਸ਼ੇਸ਼ ਭੂਮਿਕਾ ਨਿਭਾ ਰਹੀ ਹੈ ਕਿਉਂਕਿ ਜਿਹੜੀ ਪੰਜਾਬੀ ਭਾਸ਼ਾ ਹੈ ਅਤੇ ਹਿੰਦੀ ਭਾਸ਼ਾ ਹੈ ਇਹਨਾਂ ਦਾ ਆਪਸ ਵਿੱਚ ਕਾਫੀ ਗੂੜਾ ਰਿਸ਼ਤਾ ਅਤੇ ਪੰਜਾਬੀ ਭਾਸ਼ਾ ਅੱਜ ਕੱਲ੍ਹ ਜਿਵੇਂ ਅਸੀਂ ਦੇਖ ਰਹੇ ਹਾਂ ਫਿਲਮਾਂ ਵਿੱਚ ਵੀ ਦੇਖ ਰਹੇ ਹਿੰਦੀ ਫਿਲਮਾਂ ਵਿੱਚ ਵੀ ਦੇਖ ਰਹੇ ਅਤੇ ਪੰਜਾਬੀ ਗਾਣੇ ਵੀ ਅਸੀਂ ਦੇਖਦੇ ਹਾਂ ਫਿਲਮਾਂ ਵਿੱਚ ਮਹੱਤਵਪੂਰਨ ਤਰੀਕੇ ਨਾਲ ਆ ਰਹੇ ਨੇ ਅਤੇ ਹਰ ਲਗਭਗ ਹਿੰਦੀ ਫਿਲਮ ਵਿੱਚ ਇੱਕ ਅੱਧਾ ਪੰਜਾਬੀ ਗਾਣਾ ਅਤੇ ਪੰਜਾਬੀ ਕਰੈਕਟਰ ਨੂੰ ਲਿਆ ਜਾਂਦਾ ਇਸ ਲਈ ਇਹ ਸਾਰੇ ਦੇਸ਼ ਦੀ ਲਗਭਗ ਦੂਜੀ ਭਾਸ਼ਾ ਬਣਦੀ ਜਾ ਰਹੀ ਹੈ ਸਾਡੇ ਮੁਤਾਬਿਕ ਤਾਂ ਅਤੇ ਇਹਦਾ ਜਿਹੜਾ ਰਿਸ਼ਤਾ ਪੰਜਾਬੀ ਦਾ ਹਿੰਦੀ ਨਾਲ ਇੱਕ ਕਿਸਮ ਦਾ ਦੋ ਸਕੀਆਂ ਭੈਣਾਂ ਵਾਲਾ ਰਿਸ਼ਤਾ ਸਾਨੂੰ ਲੱਗ ਰਿਹਾ ਇਸ ਲਈ ਪੰਜਾਬੀ ਆ ਜਿਹੜੀ ਪੰਜਾਬ ਦੀ ਇੱਕ ਕਿਸਮ ਦੀ ਅਸੀਂ ਇਹਨੂੰ ਮਾਂ ਬੋਲੀ ਮੰਨਦੇ ਹਾਂ ਅਤੇ ਇਹ ਜਿਹੜੀ ਭਾਸ਼ਾ ਹੈ ਇਹ ਪਾਕਿਸਤਾਨ ਵਿੱਚ ਵੀ ਬੜੀ ਬੋਲੀ ਜਾਂਦੀ ਹੈ ਇਸ ਤਰ੍ਹਾਂ ਇਹ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਭਾਸ਼ਾ ਅਤੇ ਦੋਨਾਂ ਪੰਜਾਬ ਜੋ ਲਹਿੰਦਾ ਪੰਜਾਬ ਪਾਕਿਸਤਾਨ ਵਿੱਚ ਰਹਿ ਗਿਆ ਅਤੇ ਚੜ੍ਹਦਾ ਪੰਜਾਬ ਇੱਧਰ ਸਾਡੇ ਇੰਡੀਆ ਵਾਲੇ ਪਾਸੇ ਹੈ ਇਹਨਾਂ ਦੋਵੇਂ ਭਾਸ਼ਾਵਾਂ ਦਾ ਆਪਸ ਵਿੱਚ ਬੜਾ ਗੂੜ੍ਹਾ ਸੰਬੰਧ ਹੈ ਤਾਲਮੇਲ ਹੈ ਪੰਜਾਬੀ ਭਾਸ਼ਾ ਅਤੇ ਹਿੰਦੀ ਨਾਲ ਜਿਹੜਾ ਗਹਿਰਾ ਰਿਸ਼ਤਾ ਹੈ